ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਬੇਟਾ ਕੈਨੇਡਾ ਜਾਣ ਲਈ ਸਿਕਸ ਈ ਚਾਹੀਦੇ ਹਨ ਅਤੇ ਆਪਣੇ ਨਾ ਏਥੇ ਚਾਰ ਮੋਡੀਊਲਸ ਹੁੰਦੇ ਹਨ ਜਿਵੇਂਂ ਕੀ ਇੱਕ ਰੀਡਿੰਗ ਹੋਗੀ ਜਿਹਦੇ ਵਿੱਚੋਂ ਤੁਸੀਂ ਪੈਸੇਜ਼ 'ਚੋਂ ਫਾਈਂਡ ਕਰਕੇ ਕੁਐਸ਼ਨ ਐਨਸੇਅਰਜ਼ ਕਰਨੇ ਹੁੰਦੇ ਨੇ ਅਤੇ ਸੈਕਿੰਡ ਹੋਗਿਆ ਆਪਣੀ ਰਾਈਟਿੰਗ ਜਿਹਦੇ 'ਚ ਤੁਹਾਨੂੰ ਇੱਕ ਟੋਪਿਕ ਦਿੱਤਾ ਜਾਊਂਗਾ ਤੋਂ ਓਹਤੋ ਬਾਅਦ ਤੁਸੀਂ ਉਹਨੂੰ ਇਲੈਬੋਰੇਟ ਕਰਨਾ ਹੁੰਦਾ ਹੈ ਆਫਟਰ ਦੈਟ ਗਿਆ ਲੀਸਨਿੰਗ ਲੀਸਨਿੰਗ 'ਚ ਬੇਟਾ ਇਦਾਂ ਹੁੰਦਾ ਆ ਤੁਸੀਂ ਤੁਹਾਨੂੰ ਈਅਰ ਫੋਨਸ ਮਿਲਣਗੇ ਅਤੇ ਤੁਸੀਂ ਉਨ੍ਹਾਂ ਨੂੰ ਲਾ ਕੇ ਜੋ ਉਹ ਬੋਲ਼ਣਗੇ ਤੁਸੀਂ ਉਹ ਸੁਣ ਕੇ ਓਹਦਾ ਆਨਸਰ ਲਿਖਣਾ ਆ ਵੀ ਕੀ ਆ ਅਤੇ ਲਾਸਟ ਆ ਗਿਆ ਆਪਣੀ ਲੀਸਨਿੰਗ ਸਪੀਕਿੰਗ ਸਪੀਕਿੰਗਸ ਬੇਟਾ ਤੁਹਾਨੂੰ ਕੁਆਸ਼ਚਨਜ਼ ਪੁੱਟ ਕਰੇ ਜਾਣਗੇ ਤੁਸੀਂ ਓਹਦੇ ਅਕੋਡਿੰਗ ਆਪਣਾ ਆਨਸਰਜ਼ ਦੇਣਾ ਜਿਵੇਂ ਫੋਲੋ ਕੁਆਸ਼ਚਨਜ਼ ਹੋਗੇ ਇੰਟਰੋਡਕਸ਼ਨ ਕੁਆਸ਼ਚਨਜ਼ ਹੋਗੇ ਇੱਕ ਕਿਊ ਕਾਰਡ ਹੋ ਗਿਆ ਹੈ ਨਾ ਅਤੇ ਹਾਂਜੀ ਬੇਟਾ ਇਸ 'ਚ ਡਿਪੈਂਡ ਔਨ ਯੂ ਤੁਹਾਡੇ ਕਿੰਨੇ ਬੈਂਡ ਨੇ ਤੁਹਾਡੇ ਕਿੰਨੇ ਸਕੋਰ ਨੇ ਪਲੱਸ ਟੂ ਵਿੱਚ ਕਿੰਨੇ ਸਕੋਰ ਨੇ ਤੁਹਾਡੇ ਪਲੱਸ ਟੂ ਵਿੱਚ ਕਿੰਨੇ ਪ੍ਰਸੈਂਟਏਜ਼ ਹੈ ਓਕੇ ਸੀ ਬੀ ਐੱਸ ਈ ਬੋਰਡ ਤੋਂ ਕੀਤੀ ਹੋਈ ਆ ਬਸ ਫਿਰ ਬੇਟਾ ਓਹੀ ਮੈਕਸੀਮਮ ਟੂ ਮੈਕਸੀਮਮ ਟੂ ਮਨਥ ਤਾਂ ਬੇਟਾ ਹਰ ਇੱਕ ਬੱਚੇ ਨੂੰ ਚਾਹੀਦੇ ਹੁੰਦੇ ਹਨ ਬਟ ਜੇ ਤੁਸੀਂ ਜਿੰਨੀ ਜਲਦੀ ਤੁਸੀਂ ਕਰ ਸਕਦੇ ਓ ਤੁਸੀਂ ਓਨੀ ਜਲਦੀ ਕਰ ਸਕਦੇ ਓ ਬਾਕੀ ਕੋਈ ਨੀ ਡੋਂਟ ਵਰੀ ਤੁਸੀਂ ਵਿਜ਼ੀਟ ਕਰ ਸਕਦੇ ਹੋ ਆਫਿਸ 'ਚ ਠੀਕ ਹੈ ਐਨੀ ਟਾਈਮ ਅਤੇ ਮੈਨੂੰ ਕਾਲ ਕਰਕੇ ਮੈਂ ਤੁਹਾਨੂੰ ਪ੍ਰੋਵਾਈਡ ਕਰਦਾਗੀ ਬੁੱਕਜ਼ ਵਗੈਰਾ ਤੁਹਾਨੂੰ ਇੱਕ ਵਾਰ ਦਿਖਾਦਾਗੀ ਕੀ ਸੀਨ ਆ ਓਕੇ